ਜਦੋਂ ਮੈਂ ਸ਼ੁਰੂ ਸ਼ੁਰੂ ਵਿੱਚ ਦੌੜਨਾ ਸ਼ੁਰੂ ਕੀਤਾ ਤਾਂ ਉਦੋਂ ਕਾਫੀ ਤਰ੍ਹਾਂ ਦੀਆਂ ਸੱਟਾਂ ਦਾ ਅਨੁਭਵ ਕੀਤਾ ਜਿਵੇਂ ਕਿ ਗੋਡਿਆਂ 'ਤੇ ਸੱਟਾਂ ਲੱਗਣੀਆਂ ਦੌੜਦੇ ਸਮੇਂ ਜਾਂ ਦੌੜਦੇ ਦੌੜਦੇ ਹੀ ਡਿੱਗ ਜਾਣਾ ਜਾਂ ਦੌੜਦੇ ਸਮੇਂ ਪੈਰਾਂ ਵਿੱਚ ਮੋਚ ਆ ਜਾਣੀ ਕਾਫੀ ਤਰ੍ਹਾਂ ਦੀਆਂ ਸੱਟਾਂ ਦਾ ਜੋ ਅਨੁਭਵ ਹੋਇਆ ਪਰ ਜਦੋਂ ਟੀਚੇ 'ਤੇ ਧਿਆਨ ਕੇਂਦਰਿਤ ਹੋਵੇ ਉਦੋਂ ਸੱਟਾਂ ਨੂੰ ਬੇਧਿਆਨਾ ਕਰ ਦੇਣਾ ਚਾਹੀਦਾ ਹੈ ਜਿਵੇਂ ਪੈਰ 'ਤੇ ਮੋਚ ਆਉਣੀ ਤਾਂ ਮੈਂ ਗਰਮ ਸੇਕ ਜੋ ਪੈਰ ਨੂੰ ਦੇਣਾ ਜਾਂ ਰਵਾਇਤੀ ਤੌਰ 'ਤੇ ਜੋ ਮਾਲਸ਼ ਕਰਵਾਉਣੀ ਪੈਰਾਂ ਦੀ ਜਿੱਥੇ ਸੱਟ ਲੱਗਣੀ ਉੱਥੇ ਜੋ ਡਾਕਟਰ ਤੋਂ ਪੱਟੀ ਵਗੈਰਾ ਜਾਂ ਦਵਾਈ ਲੈਣੀ ਅਤੇ ਕਾਫੀ ਅਨੁਭਵ ਕੀਤਾ ਸੱਟਾਂ 'ਤੇ ਕਿਉਂਕਿ ਜਦੋਂ ਆਪਾਂ ਕਿਸੇ ਟੀਚੇ ਲਈ ਮਿਹਨਤ ਕਰਦੇ ਹਾਂ ਤਾਂ ਥੋੜ੍ਹੀਆਂ ਬਹੁਤੀਆਂ ਸੱਟਾਂ ਦਾ ਲੱਗਣਾ ਤਾਂ ਸੁਭਾਵਿਕ ਹੀ ਹੈ